ਰੂਪਨਗਰ ਜ਼ਿਲ੍ਹੇ ਦੇ ਵਿੱਚ ਮਨੁੱਖ ਮੁੱਖ ਮਨੋਰੰਜਕ ਗਤੀਵਿਧੀਆਂ ਜਿਵੇਂ ਕਿ ਟਰੇਡ ਫੇਅਰ ਸਰਸ ਮੇਲਾ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਦੇ ਮੇਲੇ ਹਨ ਜਿਹੜੇ ਕਿ ਇਹ ਰੂਪਨਗਰ ਜ਼ਿਲ੍ਹੇ ਵਿੱਚ ਮ ਲੱਗਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵੀ ਹੁੰਦੇ ਹਨ ਉਸ ਤੋਂ ਬਾਅਦ ਸਮਾਨ ਦੀ ਖਰੀਦ ਕਰਨ ਦੇ ਲਈ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਹਨ ਇਸ ਤੋਂ ਬਿਨਾਂ ਇਤਿਹਾਸਿਕ ਜਗ੍ਹਾ ਜਿੱਦਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਉਸ ਤੋਂ ਬਿਨਾਂ ਹੋਲਾ ਮਹੱਲਾ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਸਭਾ ਵੀ ਦੇਖਣ ਨੂੰ ਮਿਲਦੀ ਹੈ ਇਸ ਤੋਂ ਬਿਨਾਂ ਬੱਚਿਆਂ ਦੇ ਖੇਡਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਪਾਰਕ ਜਿਹਦੇ ਵਿੱਚ ਕਿ ਕਈ ਤਰਾਂ ਦੇ ਝੂਲੇ ਲੱਗੇ ਹੋਏ ਹਨ ਜਿਹਦੇ ਨਾਲ ਕਿ ਬੱਚੇ ਆਪਣੀ ਕ ਸਰੀਰਕ ਕਸਰਤ ਵੀ ਕਰ ਸਕਦੇ ਆ ਅਤੇ ਖੇਲ਼ ਵੀ ਲੈਂਦੇ ਹਨ ਬਹੁਤ ਵਧੀਆ ਜਗ੍ਹਾ ਹੈ ਮਹਾਰਾਜਾ ਰਣਜੀਤ ਸਿੰਘ ਪਾਰਕ ਜਿੱਥੇ ਕਿ ਬੱਚੇ ਪੂਰਾ ਮਨੋਰੰਜਨ ਕਰਦੇ ਹਨ ਇਸ ਤੋਂ ਬਿਨਾਂ ਸਤਲੁਜ ਦਰਿਆ ਦੇ ਕੰਢੇ ਵੀ ਵਧੀਆ ਬਣਾਇਆ ਗਿਆ ਹੈ ਸੈਰ ਸਪਾਟੇ ਦੇ ਲਈ ਜਗ੍ਹਾ ਵਧੀਆ ਬਣੀ ਹੋਈ ਹੈ ਲੋਕ ਇੱਥੇ ਸੈਰ ਵੀ ਕਰਦੇ ਹਨ ਅਤੇ ਆਪਣਾ ਮਨੋਰੰਜਨ ਵੀ ਕਰ ਲੈਂਦੇ ਹਨ